ਜਦੋਂ ਅਸੀਂ ਕਿਤੇ ਘੁੰਮਣ ਜਾਂਦੇ ਹਾਂ ਤਾਂ ਜਿਵੇਂ ਅਸੀਂ ਸਰਦਾਰ ਹਾਂ ਤਾਂ ਸਾਨੂੰ ਪੱਗ ਬੰਨ੍ਹ ਕੇ ਜਾਣਾ ਚਾਹੀਦਾ ਹੈ ਜੇਕਰ ਅਸੀਂ ਰੋਡੇ ਹਾਂ ਤਾਂ ਸਾਨੂੰ ਹੈਲਮਟ ਨਾਲ਼ ਲੈ ਕੇ ਜਾਣਾ ਚਾਹੀਦਾ ਹੈ ਇਸ ਨਾਲ਼ ਸਾਡੀ ਸੁਰੱਖਿਆ ਰਹਿੰਦੀ ਹੈ ਅਤੇ ਦੁਰਘਟਨਾ ਹੋਣੇ ਤੋਂ ਵੀ ਅਸੀਂ ਬਚ ਜਾਂਦੇ ਹਾਂ ਅਤੇ ਹੋਰ ਜਿਵੇਂ ਅਸੀਂ ਨਾਲ਼ ਆਪਣੇ ਖਾਣ ਪੀਣ ਦਾ ਸਮਾਨ ਨਾਲ਼ ਲੈ ਕੇ ਜਾਂਦੇ ਹਾਂ ਅਤੇ ਉਹ ਸਾਨੂੰ ਨਾਲ਼ ਲੈ ਕੇ ਜਾਣਾ ਚਾਹੀਦਾ ਹੈ ਜਿਵੇਂ ਰੋਟੀ ਪਾਣੀ ਆਪਣਾ ਜੋ ਵੀ ਆਪਾਂ ਖਾਂਦੇ ਪੀਂਦੇ ਉਹ ਆਪਾਂ ਨੂੰ ਨਾਲ਼ ਲੈ ਕੇ ਜਾਣਾ ਚਾਹੀਦਾ ਹੈ ਅਤੇ ਸੁਰੱਖਿਆ ਰੱਖਣ ਦੀ ਅਤੇ ਅਸ ਮੋਟਰਸਾਈਕਲ ਆਦਿ ਜੋ ਵੀ ਆਪਣੇ ਕੋਲ ਸਾਧਨ ਹੈ ਉਸ ਨੂੰ ਘੱਟ ਸਪੀਡ 'ਤੇ ਚਲਾਉਣਾ ਚਾਹੀਦਾ ਹੈ ਜਿਸ ਨਾਲ ਦੁਰਘਟਨਾ ਹੋਣੇ ਦੇ ਘੱਟ ਚਾਣਸ ਰਹਿੰਦੇ ਆ ਅਤੇ ਹੋਰ ਵੀ ਕਈ ਚੀਜ਼ਾਂ ਏ ਜੋ ਸਾਨੂੰ ਧਿਆਨ ਰੱਖਣੀਆਂ ਚਾਹੀਦੀਆਂ ਹਨ